ਮੈਡਮ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਡਮ ਜੀ ਹੈਗਾ ਆ ਇਹ ਬਾਠ ਸਾਹਿਬ ਹੈ ਬੜਾ ਵੱਡਾ ਗੁਰਦੁਆਰਾ ਹੈ ਤੁਸੀਂ ਇੱਥੇ ਆ ਸਕਦੇ ਹੋ ਮੈਡਮ ਜੀ ਸਰਨੇ ਤੋਂ ਥੋੜ੍ਹਾ ਅੱਗੇ ਜਾ ਕੇ ਨਾ ਤੇ ਬਾਠ ਸਾਹਿਬ ਦਾ ਬੋਰਡ ਲੱਗਿਆ ਕਾਫੀ ਵੱਡਾ ਜਿਹਾ ਤੁਸੀਂ ਸੱਜੇ ਹੱਥ ਜਾ ਕੇ ਅੱਗੇ ਤੁਹਾਨੂੰ ਗੁਰਦੁਆਰਾ ਸਾਹਮਣੇ ਦਿਖਾਈ ਦੇਣਾ ਉੱਥੇ ਵੱਡਾ ਜਿਹਾ ਸਲਾ ਸਰੋਵਰ ਵੀ ਹੈ ਅੰਦਰ ਜਾ ਕੇ ਹਾਂ ਲੰਗਰ ਵੀ ਹੈ ਉੱਥੇ ਖਾਣ ਪੀਣ ਦਾ ਸਭ ਕੁਛ ਹੁੰਦਾ ਆ ਤੁਸੀਂ ਜਾ ਸਕਦੇ ਹੋ ਉੱਥੇ ਠੀਕ ਠੀਕ ਧੰਨਵਾਦ ਜੀ